ਗਿਆਰ੍ਹਾਂ ਮਾਰਚ ਉੱਨੀ ਸੌ ਸੰਨਤਾਲੀ ਛੇ ਜਨਵਰੀ ਉੱਨੀ ਸੌ ਪੰਜਾਹ ਅਠਾਰ੍ਹਾਂ ਨਵੰਬਰ ਉੱਨੀ ਸੌ ਸੱਤਰ ਛੇ ਜਨਵਰੀ ਉੱਨੀ ਸੌ ਅੱਸੀ ਸੋਲ੍ਹਾਂ ਅਕਤੂਬਰ ਦੋ ਹਜਾਰ ਦਸ